ਜੇਕਰ ਫਾਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਮੈਂ ਆਪਣੇ ਘਰ ਦੇ ਕੋਲ ਹੀ ਜਿਹੜਾ ਖੇਤ ਦੇ ਕੁਛ ਹਿੱਸੇ ਦੇ ਵਿੱਚ ਸਬਜ਼ੀਆਂ ਨੇ ਜਿਹੜੀਆਂ ਮੌਸਮੀ ਉਹ ਉਗਾਈਆਂ ਹੋਈਆਂ ਨੇ ਅਤੇ ਉਹਨਾਂ ਦੀ ਦੇਖਭਾਲ ਦੇ ਲਈ ਮੈਂ ਸਵੇਰੇ ਅਤੇ ਸ਼ਾਮ ਉੱਥੇ ਗੇੜਾ ਮਾਰਦੀ ਹਾਂ ਦੇਖਦੀ ਹਾਂ ਗੀ ਪੌਦਿਆਂ ਦਾ ਨਿਰੀਖਣ ਕੀਤਾ ਜਾਂਦਾ ਉਸ ਸਮੇਂ ਦੇ ਵਿੱਚ ਕਿ ਉਹ ਰੋਗ ਰੋਗ ਰਹਿਤ ਹੈਗੇ ਨੇ ਜਾਂ ਨਹੀਂ ਹੈਗੇ ਉਹਨਾਂ ਨੂੰ ਖਾਦ ਦੀ ਪਾਣੀ ਦੀ ਕਿੰਨੀ ਕੁ ਜ਼ਰੂਰਤ ਹੈ ਇਸ ਤੋਂ ਇਲਾਵਾ ਉਹਨਾਂ ਦੇ ਉੱਪਰ ਜੋ ਵੀ ਸਬਜ਼ੀਆਂ ਵਗੈਰਾ ਲੱਗਦੀਆਂ ਨੇਗੀਆਂ ਉਹਨਾਂ ਨੂੰ ਸਹੀ ਸਮੇਂ ਤੋੜਨਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਅਸੀਂ ਸਬਜ਼ੀਆਂ ਨੂੰ ਸਹੀ ਸਮੇਂ ਜਿਹੜਾ ਉਹ ਨਹੀਂ ਤੋੜਦੇ ਤਾਂ ਉਹ ਖਰਾਬ ਹੋ ਜਾਂਦੀਆਂ ਨੇ ਇਹਦੇ ਨਾਲ ਸਿਰਫ ਪੱਕੀ ਹੋਈ ਸਬਜ਼ੀ ਖਰਾਬ ਨਹੀਂ ਹੁੰਦੀ ਬਲਕਿ ਜਿਹੜੀ ਉਹ ਪੌਦਾ ਹੈਗਾ ਉਹਦੇ ਲਈ ਵੀ ਇਹ ਚੀਜ਼ ਨੁਕਸਾਨਦੇਹ ਹੈ ਕਿਉਂਕਿ ਉਹਦੇ ਨਾਲ ਬਾਕੀ ਜਿਹੜੀਆਂ ਸਬਜ਼ੀਆਂ ਨੇਗੀਆਂ ਜਿਹੜਾ ਆਉਣ ਵਾਲਾ ਫਲ ਹੈ ਉਹ ਵੀ ਖਰਾਬ ਹੋ ਜਾਂਦਾ ਅਤੇ ਸਹੀ ਸਮੇਂ 'ਤੇ ਨਹੀਂ ਆ ਪਾਉਂਦਾ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀ ਘਰ ਦੀ ਖੇਤੀ ਹੈਗੀ ਉਹ ਸਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਕਿਉਂਕਿ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਸਾਨੂੰ ਬਿਲਕੁਲ ਜਿਹੜੀ ਫਰੈਸ਼ ਸਬਜ਼ੀਆਂ ਨੇ ਤਾਜ਼ੀਆਂ ਸਬਜ਼ੀਆਂ ਨੇਗੀਆਂ ਮੌਸਮੀ ਉਹ ਮਿਲਦੀਆਂ ਨੇਗੀਆਂ ਦੂਸਰਾ ਇਹ ਹੈ ਕਿ ਸਾਡਾ ਸਰੀਰ ਹੈ ਜਿਹੜਾ ਉਹ ਰੇਹ ਸਪਰੇਹ ਵਾਲੀਆਂ ਸਬਜ਼ੀਆਂ ਖਾਣ ਤੋਂ ਬਚ ਜਾਂਦਾ ਹੈਗਾ ਜਿਹਦੇ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਆ